ਮੈਂ ਗਾਇਕਾਂ ਦੇ ਲਾਈਵ ਸੁਣਨ ਨੂੰ ਬਹੁਤ ਪਸੰਦ ਕਰਦੀ ਹਾਂ ਅਕਸਰ ਮੈਂ ਜਿਹੜੇ ਲਾਈਵ ਸ਼ੋ ਹੁੰਦੇ ਹਨ ਉਹਨਾਂ ਨੂੰ ਸੁਣਨ ਜਾਂਦੀ ਰਹਿੰਦੀ ਹਾਂ ਮੈਂ ਹਰਭਜਨ ਮਾਨ ਦੇ ਲਾਈਵ ਸ਼ੋਅ ਨੂੰ ਸੁਣਿਆ ਸੀ ਜਿਸ ਦੇ ਵਿੱਚ ਹਰਭਜਨ ਮਾਨ ਨੇ ਆਪਣੇ ਕੁਝ ਹਿਟ ਗਾਣਿਆਂ ਦੇ ਉੱਤੇ ਭੰਗੜਾ ਵੀ ਕੀਤਾ ਮੈਨੂੰ ਉਹ ਲਾਈਵ ਸ਼ੋ ਬਹੁਤ ਹੀ ਵਧੀਆ ਲੱਗਿਆ ਕਿਉਂਕਿ ਜਿਹੜੇ ਵੀ ਉੱਥੇ ਪਹੁੰਚੇ ਹੋਏ ਸਨ ਉਹਨਾਂ ਸਾਰਿਆਂ ਨੇ ਇਸ ਨੂੰ ਬਹੁਤ ਪਸੰਦ ਕੀਤਾ ਅਤੇ ਉਸ ਦੇ ਗਾਣਿਆਂ ਦੇ ਉੱਤੇ ਸਭ ਨੇ ਖੂਬ ਭੰਗੜਾ ਪਾਇਆ ਮੈਂ ਜਿਹੜੇ ਵੀ ਸੂਫੀ ਗਾਇਕ ਨੇ ਉਹਨਾਂ ਦੇ ਲਾਈਵ ਸ਼ੋ ਸੁਣਨਾ ਵੀ ਪਸੰਦ ਕਰਦੀ ਹਾਂ